ਮੈਂ ਇੱਕ ਸ਼ੋਪ ਕੀਪਰ ਹਾਂ ਇੱਕ ਦੁਕਾਨਦਾਰ ਹਾਂ ਅਤੇ ਚੋਣਾਂ ਦੌਰਾਨ ਜਦੋਂ ਮੇਰੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਨ ਜਾਂਦੇ ਹੈ ਤੇ ਜਦੋਂ ਚੋਣਾਂ ਦੌਰਾਨ ਉਹਨਾਂ ਉਹਨਾਂ ਦੇ ਸਕੂਲ ਦੇ ਟੀਚਰ ਉਹਨਾਂ ਦੇ ਅਧਿਆਪਕਾਂ ਦੀ ਡਿਊਟੀਆਂ ਲੱਗ ਜਾਂਦੀਆਂ ਹਨ ਤੇ ਬੱਚਿਆਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉੱਥੇ ਪੜ੍ਹਾਈ ਵਾਸਤੇ ਅਧਿਆਪਕ ਉਪਲਬਧ ਨਹੀਂ ਹੁੰਦੇ ਕਿਉਂਕਿ ਉਹ ਡਿਊਟੀ ਡਿਊਟੀਆਂ ਦੇ ਹੁੰਦੇ ਹਨ ਤੇ ਇਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ਦੂਸਰਾ ਨੰਬਰ ਬੱਚੇ ਘਰ ਦੇ ਵਿੱਚ ਹੁੰਦੇ ਹਨ ਅਤੇ ਮੈਂ ਉਹਨਾਂ ਨੂੰ ਉਹਨਾਂ ਦਾ ਧਿਆਨ ਨਹੀਂ ਰੱਖ ਸਕਦੀ ਕਿਉਂਕਿ ਬੱਚੇ ਘਰ ਦੇ ਵਿੱਚ ਹੁੰਦੇ ਹਨ ਮੈਂ ਦੁਕਾਨ ਤੇ ਹੁੰਦੀ ਹਾਂ ਤੇ ਮੈਨੂੰ ਆਪਣੇ ਕੰਮ ਨੂੰ ਕਰਨ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜਾ ਉਸ ਤੋਂ ਬਾਅਦ ਬੱਚੇ ਸਕੂਲਾਂ ਦੇ ਵਿੱਚ ਸਕੂਲ ਸਕੂਲਾਂ ਦੇ ਵਿੱਚ ਪੋਲਿੰਗ ਬੂਥ ਬਣ ਜਾਂਦੇ ਹਨ ਅਤੇ ਉੱਥੇ ਜਾ ਕੇ ਬੱਚੇ ਪੜ੍ਹ ਨਹੀਂ ਸਕਦੇ ਹਨ ਉਨੇ ਦਿਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਹੀ ਨੁਕਸਾਨ ਹੁੰਦਾ ਹੈ ਅਤੇ ਫਿਰ ਉਥੇ ਟਰੈਫਿਕ ਬਹੁਤ ਜਿਆਦਾ ਆਵਾਜਾਈ ਦੇ ਸਾਧਨਾਂ ਦੇ ਵਿੱਚ ਦਿੱਕਤ ਆਣ ਤੱਕ ਸਾਹਮਣਾ ਕਰਨਾ ਪੈਂਦਾ ਹੈ ਬਾਜ਼ਾਰ ਬਾਜ਼ਾਰਾਂ ਦੇ ਵਿੱਚ ਰਸ਼ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਸਪੀਕਰਾਂ ਨੂੰ ਲੈ ਕੇ ਟੈਂਪੋ ਵਗੈਰਾ ਤੁਰੇ ਹੁੰਦੇ ਹਨ ਜਿਹੜੇ ਕਿ ਬਹੁਤ ਸ਼ੋਰ ਸ਼ਰਾਬਾ ਕਰਦੇ ਹਨ ਸਾਨੂੰ ਆਪਣੇ ਕੰਮ ਕਾਜ ਦੇ ਵਿੱਚ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਧੰਨਵਾਦ